ਸਤਿ ਸ਼੍ਰੀ ਅਕਾਲ ਮੇਰੇ ਗੁਆਂਢੀ ਵਿੱਚ ਇੱਕ ਭਾਅ ਜੀ ਰਹਿੰਦੇ ਹਨ ਉਹਨਾਂ ਨੇ ਬੀਐਡ ਦੀ ਡਿਗਰੀ ਲਈ ਹੋਈ ਹੈ ਡਿਗਰੀ ਦਾ ਬਹੁਤ ਹੀ ਫ਼ਾਇਦਾ ਹੈ ਉਹਨਾਂ ਵੱਲ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਸਾਨੂੰ ਕਿ ਡਿਗਰੀ ਦਾ ਬਹੁਤ ਹੀ ਫ਼ਾਇਦਾ ਹੈ ਕਿਉਂਕਿ ਉਹਨਾਂ ਨੇ ਉਸ ਡਿਗਰੀ ਦੇ ਉਸ ਦੀ ਮਦਦ ਨਾਲ ਹੀ ਬਹੁਤ ਸਾਰੀ ਨੌਕਰੀ ਨੌਕਰੀ ਹਾਸਿਲ ਕੀਤੀਆਂ ਹਨ ਉਸ ਉਸ ਨੇ ਇ ਇੱਦਾਂ ਦੀ ਨੌਕਰੀਆਂ ਵੀ ਹੁੰਦੀਆਂ ਹਨ ਜਿਸ ਵਿੱਚ ਡਿਗਰੀ ਦੇ ਬਿਨਾਂ ਆਪਾਂ ਕੋਈ ਫੋਰਮ ਫਿਲ ਹੀ ਨਹੀਂ ਕਰ ਸਕਦੇ ਉਸ ਜਦੋਂ ਹੁਣ ਉਹ ਬੀਟ ਹੁਣ ਉਹ ਪ੍ਰੋਫੈਸਰ ਲੱਗੇ ਹੋਏ ਹਨ ਇੱਕ ਕੋਲੇਜ ਵਿੱਚ ਮੈਂ ਬਚਪਨ ਤੋਂ ਹੀ ਉਹਨਾਂ ਤੋਂ ਪੜ੍ਹੀ ਹਾਂ ਉਹ ਉਹਨਾਂ ਉਹ ਆਪਣੇ ਆਪ ਉਹ ਉਹ ਫੀਸ ਫੀਸ ਵੀ ਘੱਟ ਕਰਵਾ ਦਿੰਦੇ ਹਨ ਹੋਰ ਬੱਚਿਆਂ ਦੀ ਜਿਹੜੇ ਗਰੀਬ ਹੁੰਦੇ ਹਨ ਉਹ ਮਦਦ ਵੀ ਕਰਦੇ ਹਨ ਉਹ ਉਹ ਉਹ ਉਹਨਾਂ ਵੱਲ ਦੇਖ ਕੇ ਪਤਾ ਲੱਗਦਾ ਹੈ ਕਿ ਡਿਗਰੀ ਦੀ ਬਹੁਤ ਮਹੱਤਤਾ ਹੈ ਕਿਉਂਕਿ ਉਸ ਡਿਗਰੀ ਦੇ ਮੁਤਾਬਿਕ ਹੀ ਉਹਨਾਂ ਨੇ ਇੱਕ ਜੋਬ ਲਈ ਹੈ ਅਤੇ ਉਹਨਾਂ ਦਾ ਹੁਣ ਕੋਠੀ ਦੇਖਣੀ ਹੋਈ ਤੇ ਬਹੁਤ ਵੱਡੀ ਕੋਠੀ ਹੈ ਇੱਕ ਬਹੁਤ ਵੱਡੀ ਲਗਜ਼ਰੀ ਕਾਰ ਹੈ ਜਿਹਨਾਂ ਵੱਲ ਦੇਖ ਕੇ ਮੈਨੂੰ ਆਪਣੇ ਆਪ 'ਚ ਹੁੰਦਾ ਹੈ ਕਿ ਇੱਕ ਡਿਗਰੀ ਨੂੰ ਹਾਸਿਲ ਕਰਨਾ ਬਹੁਤ ਹੀ ਜ਼ਿਆਦਾ ਹੈ ਮਹੱਵ ਮਹੱਤਵਪੂਰਨ ਹੈ ਧੰਨਵਾਦ ਜੀ